ਨਹੀਂ ਮੈਂ ਇਹ ਨਹੀਂ ਸੋਚਦੀ ਹਾਂ ਕਿ ਮੇਰੀ ਲਿਖਤ ਦੇ ਵਿੱਚ ਅਤੇ ਦੂਸ ਦੂਸਰੇ ਲੇਖਕਾਂ ਦੀ ਲਿਖਤ ਦੇ ਵਿੱਚ ਕੁਝ ਵੱਖਰਾ ਹੈ ਹਾਂ ਮੈਂ ਇਹ ਜ਼ਰੂਰ ਸੋਚਦੀ ਹਾਂ ਕਿ ਹਰ ਬੰਦੇ ਦਾ ਇੱਕ ਲਿਖਣ ਦਾ ਜੋ ਢੰਗ ਹੈ ਉਹ ਅਨੁਭਵ ਕਰਨ ਦਾ ਢੰਗ ਹੈ ਉਹ ਵੱਖਰਾ ਹੁੰਦਾ ਹੈ ਅਤੇ ਮੈਂ ਆਪਣਿਆਂ ਆਸ ਪਾਸ ਆਪਣੀ ਕੁਦਰਤ ਜੋ ਵੀ ਚੱਲ ਰਿਹਾ ਹੈ ਜੋ ਵੀ ਕਿਸੇ ਦੇ ਨਾਲ ਵਿਚਰ ਰਿਹਾ ਹੈ ਉਸ ਨੂੰ ਚੰਗੀ ਤਰ੍ਹਾਂ ਅਨੁਭਵ ਕਰਕੇ ਆਪਣੇ ਅੰਦਰ ਤੋਂ ਅਨੁਭਵ ਕਰਕੇ ਚੰਗੀ ਤਰ੍ਹਾਂ ਕਲਮ ਦੇ ਨਾਲ ਕਾਗਜ਼ ਦੇ ਉੱਤੇ ਉਤਾਰਦੀ ਹਾਂ ਤੇ ਮੈਂ ਆਪਣੇ ਦਿਲ ਵਿੱਚ ਵੈਸੇ ਤਾਂ ਕੋਈ ਸੁਧਾਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਹਰ ਬੰਦਾ ਆਪਣੇ ਅਨੁਭਵ ਦੇ ਨਾਲ ਲਿਖਦਾ ਹੈ ਹਰ ਬੰਦੇ ਦਾ ਸੋਚਣ ਦਾ ਤਰੀਕਾ ਅਲੱਗ ਹੈ ਜੋ ਅਨੁਭਵ ਕਰਦਾ ਕਿਸੇ ਚੀਜ਼ ਨੂੰ ਦੇਖ ਕੇ ਉਹ ਅਲੱਗ ਹੈ ਪ੍ਰੰਤੂ ਹਾਂ ਇਹ ਜ਼ਰੂਰ ਹੈ ਕਿ ਚੰਗੀ ਤਰ੍ਹਾਂ ਹੋਰ ਉਸ ਨੂੰ ਡੀਪਲੀ ਕਿਸੇ ਤਰੀਕੇ ਦੇ ਨਾਲ ਸੋਚ ਕੇ ਜੋ ਵੀ ਆਪਣੇ ਅੱਗੇ ਵਧਣ ਦੇ ਲਈ ਮੈਂ ਸੁਧਾਰ ਕਰਨਾ ਚਾਹੁੰਦੀ ਹਾਂ